ਹੈਲੋ ਸਤਿ ਸ਼੍ਰੀ ਅਕਾਲ ਜੀ ਕਿਵੇਂ ਹਾਲ ਆ ਜੀ ਸਭ ਵਧੀਆ ਜੀ ਮੈਨੂੰ ਸਰ ਮੇਰੇ ਦੋਸਤ ਤਰਨਵੀਰ ਨੇ ਤੁਹਾਡੇ ਬਾਰੇ ਦੱਸਿਆ ਸੀਗਾ ਏ ਟੂ ਯੈਡ ਕੰਪਨੀ ਤੋਂ ਬੋਲ ਰਹੇ ਜੀ ਉਹ ਸਰ ਤੁਹਾਡੇ ਕੋਲ ਨਾ ਇੱਕ ਹਜੂਰ ਸਾਹਿਬ ਦਾ ਪਲੈਨ ਸੀਗਾ ਅਤੇ ਉਹ ਮੈਨੂੰ ਦੱਸ ਸਕਦੇ ਕਿ ਕਿਆ ਕਿਆ ਸੀਗਾ ਉਹਦਾ ਸੀਗਾ ਪਲੈਨ ਬਾਰੇ ਜੀ ਨਹੀਂ ਦੱਸ ਦਿਓ ਤੁਸੀਂ ਦੋਨੋਂ ਤਰੀਕੇ ਨਾਲ ਦੱਸ ਦਿਓ ਜੇ ਇਕੱਲੇ ਜਾਣਾ ਕਿਸ ਹਿਸਾਬ ਨਾਲ ਪਊਗਾ ਜੇ ਫੈਮਲੀ ਨਾਲ ਕਰਨਾ ਪਉ ਤਾਂ ਕਿਸ ਹਿਸਾਬ ਨਾਲ ਪਊਗਾ ਜੀ ਉਹ ਹਾਂਜੀ

ਅੱਛਿਆ ਜੀ ਅਤੇ ਹੋਰ ਸਹੂਲਤਾਂ ਕਿਆ ਕਿਆ ਰਹਿਣ ਸਹਿਣ ਦਾ ਖਰਚਾ ਖਾਣ ਪੀਣ ਦਾ ਜੀ

ਅੱਛਾ ਜੀ ਅੱਛਾ ਜੀ

ਅੱਛਾ ਜੀ ਫਿਰ ਤੁਹਾਨੂੰ ਜਿਹੜਾ ਅਸੀਂ ਪੇਅ ਕਰਨਾ ਜੀ ਤੁਹਾਨੂੰ ਜਾਣ ਵੇਲੇ ਪੇਅ ਕਰਨਾ ਕਿ ਬਾਅਦ 'ਚ ਜਦੋਂ ਪੂਰੀ ਸਾਡਾ ਹੋਊਗਾ ਤਾਂ ਤੁਹਾਨੂੰ ਪੇਅ ਕਰਨਾ ਸਾਰੀ ਜਦੋਂ ਹੀ

ਅੱਛਾ ਰਿਫੰਡ ਫੀਸ ਮਤਲਬ ਹੈਗੀ ਸਾਡੀ ਬਾਏ ਐਂਡ ਕਿਤੇ ਪਲੈਨ ਕੈਂਸਲ ਹੋ ਜਾਵੇ ਹੈ ਨਾ ਠੀਕ ਐ ਜੀ ਜਿਹੜੇ ਰਸਤੇ ਵਿੱਚ ਕੋਈ ਹੋਰ ਧਾਰਮਿਕ ਸਥਾਨ ਆ ਜਾਏ ਤੁਸੀਂ ਉਹ ਵੀ ਸਾਨੂੰ ਦਿਖਾਓਗੇ ਕਿ ਤੁਸੀਂ ਜਿਹੜੇ ਸ਼ਹਿਰ 'ਚ ਉਹ ਦਿਖਾਓਗੇ

ਅੱਛਾ ਅੱਛਾ ਜੀ ਅਤੇ ਇੱਕ ਹੋਰ ਮਨ ਲਓ ਛੋਟੇ ਬੱਚੇ ਬਾਰੇ ਅਲੱਗ ਪਲੈਨ ਆ ਬੜੇ ਬੰਦੇ ਦਾ ਸੇਮ ਪਲੈਨ ਆ ਜੀ ਕੁਛ ਚਾਰ ਹਜ਼ਾਰ ਰੁਪਇਆ ਚਾਰਜ ਕਰਦੇ ਠੀਕ ਹੈ

ਅੱਛਾ ਅੱਛਾ ਜੀ ਯਾਨੀ ਤੁਸੀਂ ਹੋਰ ਵੀ ਸਾਨੂੰ ਕਿਤੇ ਹੋਰ ਵੀ ਮਤਲਬ ਗੁਰਦੁਆਰੇ ਕੰਨੀ ਘੁੰਮਾਉਣਾ ਕਿ ਹੋਰ ਲਾਗ ਪਾਸ ਹੋਰ ਵੀ ਤੁਸੀਂ ਘੁੰਮਾ ਸਕਦੇ ਤੁਸੀਂ ਸਾਨੂੰ

ਠੀਕ ਹੈ ਜੀ ਚਲੋ ਠੀਕ ਹੈ ਸਰ ਮੈਂ ਤੁਹਾਨੂੰ ਦੱਸ ਦੇਵਾਂਗਾ ਜਿਵੇਂ ਵੀ ਹੋਇਆ ਜੀ ਜੇ ਠੀਕ ਹੈ ਜੇ ਆਪਾਂ ਬੁੱਕ ਕਰਾਉਣਾ ਤੁਹਾਨੂੰ ਰਾਤ ਹੀ ਕਰ ਦੇਵਾਂਗੇ ਕੁਛ ਉਸ ਹਿਸਾਬ ਨਾਲ ਕਰ ਲਵਾਂਗੇ ਜੀ ਠੀਕ ਹੈ ਧੰਨਵਾਦ ਜੀ